ਹੈਲੋ ਹਾਂ ਸਤਿ ਸ਼੍ਰੀ ਅਕਾਲ ਸਰ ਹਾਂ ਸਰ ਗੁਰਦੁਆਰਾ ਸਿੰਘ ਸਭਾ ਜਲੰਧਰ ਤੋਂ ਗੱਲ ਕਰ ਰਹੇ ਹਾਂਜੀ ਸਰ ਮੈਂ ਤੁਹਾਡੇ ਦੋ ਮਿੰਟ ਲੈਣਾ ਚਾਹੁੰਦਾ ਸੀ ਮੈਂ ਸਰ ਤਹਿਸੀਲ ਡੇਵਿਡ ਪਤਰਿਕਾ ਤੋਂ ਗੱਲ ਕਰ ਰਿਹਾ ਸੀ ਸਰ ਫਰੀ ਹੋ ਜੀ ਹਾਂਜੀ ਸਰ ਮੈਂ ਥੋੜ੍ਹਾ ਜਿਹਾ ਇਹਦੇ ਖਾਲਸਾ ਪੰਥ ਦੀ ਸਥਾਪਨਾ ਦੇ ਬਾਰੇ ਔਰ ਉਹਦੀ ਸਿਰਜਣਾ ਦੇ ਬਾਰੇ ਦੋ ਕੁ ਸਵਾਲ ਸੀਗੇ ਮੇਰੇ ਜੇ ਤੁਹਾਡਾ ਤੁਹਾਡੇ ਕੋਲ ਟਾਈਮ ਹੋਵੇ ਤਾਂ ਉਹਦੇ ਬਾਰੇ ਮੈਨੂੰ ਥੋੜ੍ਹਾ ਜਿਹਾ ਜਾਣਨਾ ਚਾਹੁੰਦਾ ਸੀ ਮੈਂ ਹਾਂਜੀ ਸਰ ਆਪਾਂ ਇੱਕ ਨਾ ਉਹ ਪਤਰਿਕਾ ਦੇ ਵਿੱਚ ਲੇਖ ਲਿਖਣਾ ਚਾਹੁੰਦੇ ਸੀ ਉਹਦੇ ਲਈ ਆਪਾਂ ਉਹਦੇ ਬਾਰੇ 'ਚ ਜਾਣਨਾ ਚਾਹੁੰਦੇ ਸੀ

ਹਾਂ ਸਰ ਇੱਕ ਪਹਿਲਾਂ ਦੱਸੋ ਜੀ ਇਹਦੀ ਖਾਲਸਾ ਪੰਥ ਦੀ ਸਥਾਪਨਾ ਕਦੋਂ ਹੋਈ ਸੀ ਜੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਗੁਰੂ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਠੀਕ ਹੈ ਜਿਹੜੇ ਮੁਗਲ ਮੁਗਲ ਰਾਜੇ ਸੀ ਹਾਂਜੀ ਹਾਂਜੀ ਜੀ ਜੀ

ਜੀ ਜੀ ਜੀ ਓਕੇ ਇਹ ਸਰ ਕਿਹ ਕਦੋਂ ਇਹਦੀ ਸਿਰਜਣਾ ਹੋਈ ਸੀ ਸਰ ਵਿਸਾਖੀ ਦੇ ਦਿਨ ਓਕੇ ਅਤੇ ਇਹ ਸਰ ਆਪਣੇ ਜਿਹੜੇ ਖਾਲਸਾ ਪੰਥ ਜੀ ਜਿਹੜਾ ਇਹ ਕਿੱਥੇ ਸਿਰਜਨਾ ਕੀਤੀ ਗਈ ਸੀ ਅਤੇ ਪੰਜਾਬ ਵਿੱਚ ਅਨੰਦਪੁਰ ਸਾਹਿਬ ਹਾਂਜੀ ਹਾਂਜੀ ਹਾਂਜੀ

ਅਤੇ ਪੰਜ ਪਿਆਰਿਆਂ ਦਾ ਕੀ ਮਤਲਬ ਹੁੰਦਾ ਸਰ ਜੀ

ਓਕੇ ਓਕੇ ਅੱਛਾ ਅੱਛਾ ਅੱਛਾ ਅੱਛਾ ਬਹੁਤ ਵਧੀਆ ਬਹੁਤ ਵਧੀਆ ਜੀ ਜੀ ਜੀ ਜੀ ਉਸ ਤੋਂ ਪਹਿਲਾਂ ਜਿਹੜਾ ਸੀ ਇਹ ਮਤਲਬ ਜਿਹੜਾ ਸਿਸਟਮ ਸੀ ਇਹ ਜਿਹੜਾ ਖਾਲਸਾ ਪੰਥ ਉਸ ਤੋਂ ਪਹਿਲਾਂ ਵੀ ਸੀ ਉਸ ਤੋਂ ਬਾਅਦ ਹੀ ਹੋਂਦ 'ਚ ਆਇਆ ਓਕੇ ਓਕੇ ਪਹਿਲਾਂ ਗੁਰੂਆਂ ਗੁਰੂਆਂ ਦੇ ਆਦੇਸ਼ਾਂ ਅਨੁਸਾਰ ਸਭ ਚੱਲਦਾ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲੇ ਗੁਰੂ ਸੀ ਨਾ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜੀ ਤੁਹਾਡਾ ਤੁਸੀਂ ਆਪਣੇ ਬਿਜ਼ੀ ਸ਼ਡਿਊਲ ਚੋਂ ਟਾਈਮ ਦਿੱਤਾ ਸਾਨੂੰ ਸਰ ਬਹੁਤ ਬਹੁਤ ਧੰਨਵਾਦ ਸਰ ਸਤਿ ਸ਼੍ਰੀ ਅਕਾਲ